ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਭੂਰੂ ਦੇ ਢਾਬਾ ਸੱਤ ਫੇਸ ਤੋਂ ਹੋ ਰਹੀ ਹੈ ਮਨਮੀਤ ਸਿੰਘ ਜੀ ਨਾਲ ਮੈਂ ਕੁਛ ਟਾਈਮ ਪਹਿਲਾਂ ਆਪਣਾ ਖਾਣ ਪੀਣ ਦਾ ਔਡਰ ਪਲੇਸ ਕੀਤਾ ਸੀਗਾ ਜਿਹਦੇ ਵਿੱਚ ਮੈਂ ਇੱਕ ਪਨੀਰ ਟਿੱਕਾ ਇਕ ਪਨੀਰ ਬਟਰ ਮਸਾਲਾ ਅਤੇ ਤੰਦੂਰੀ ਨਾਨ ਅਤੇ ਸਪਰਿੰਗਰੋ ਮਨਚੂਰੀਅਨ ਐਂਡ ਮੋਮੋਜ਼ ਔਡਰ ਕੀਤੇ ਸੀਗੇ ਐਕਚੁਲੀ ਮੇਰੇ ਫਰੈਂਡਜ਼ ਚਾਰ ਹੋਰ ਆ ਗਏ ਹਨ ਅਤੇ ਮੈਂ ਉਹੀ ਔਡਰ ਡਬਲ ਕਰਵਾਉਣਾ ਚਾਹੁੰਦੀ ਹਾਂ ਕੀ ਮੈਨੂੰ ਸਪਰਿੰਗ ਰੋਲਜ਼ ਔਰ ਮੋਮੋਜ਼ ਨਾਲ ਜਿਹੜੀ ਉਹਦੀ ਖੱਟੀ ਮਿੱਠੀ ਚੱਟਨੀ ਆ ਉਹ ਡਬਲ ਮਿਲ ਸਕਦੀ ਆ ਅਤੇ ਕੀ ਇਹ ਔਡਰ ਜਲਦੀ ਤੋਂ ਜਲਦੀ ਹੋ ਸਕਦਾ ਆ ਇਹ ਅਰਜੰਟ ਹੈਗਾ ਅਤੇ ਜੇ ਮੇਰੇ ਕੋਲ ਨਾ ਐਕਚੁਲੀ ਕੈਸ਼ ਘੱਟ ਆ ਅਤੇ ਗੂਗਲ ਪੇ ਦੀ ਜਿਹੜੀ ਸੰਭਾਵਨਾ ਉਹ ਜਿਆਦਾ ਆ ਕੀ ਤੁਸੀਂ ਜਿਹੜਾ ਡਿਲੀਵਰੀ ਬੋਆਏ ਹੋਵੇਗਾ ਉਹਦੇ ਨਾਲ ਆਪਣਾ ਸਕੈਨਰ ਭੇਜ ਸਕਦੇ ਹੋ ਤਾਂ ਕਿ ਮੈਂ ਤੁਹਾਡੀ ਪੇਮੈਂਟ ਕਲੀਅਰ ਕਰ ਸਕਾਂ ਅਤੇ ਪਲੀਜ਼ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਥੋੜ੍ਹਾ ਵਧੀਆ ਤਰੀਕੇ ਨਾਲ ਬਣਾ ਕੇ ਭੇਜੋ ਸਾਡੇ ਘਰ ਗੈਸਟ ਫਸਟ ਟਾਈਮ ਆਏ ਹਨ ਤਾਂ ਕਿ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਬਹੁਤ ਹੀ ਵਧੀਆ ਰੈਸਟੋਰੈਂਟ ਚੋਂ ਮੰਗਵਾਇਆ ਏ ਅਤੇ ਔਲਵੇਜ਼ ਅਸੀਂ ਤੁਹਾਡੇ ਰੈਸਟੋਰੈਂਟ 'ਚ ਆਉਂਦੇ ਜਾਂਦੇ ਰਹਿੰਦੇ ਹਾਂ ਬਟ ਅੱਜ ਮਜਬੂਰੀ ਹੋ ਗਈ ਮੀਂਹ ਕਾਰਨ ਅਸੀਂ ਆ ਨਹੀਂ ਸਕੇ ਇੱਥੇ ਨਹੀਂ ਤਾਂ ਮੈਂ ਖੁਦ ਹੀ ਆ ਕੇ ਪੈਕ ਕਰਾ ਕੇ ਲੈ ਕੇ ਜਾਣਾ ਸੀਗਾ ਬਟ ਚਲੋ ਮੈਂ ਡਿਲੀਵਰੀ ਬੋਆਏ ਰਾਹੀਂ ਕਰਤਾ ਅਤੇ ਮੇ ਬੀ ਤੁਸੀਂ ਮੈਨੂੰ ਜਾਣਦੇ ਵੀ ਹੋਊਂਗੇ ਸੁਮਨਪ੍ਰੀਤ ਨੂੰ ਅਤੇ ਪਲੀਜ਼ ਮੇਰਾ ਔਡਰ ਜਲਦੀ ਜਲਦੀ ਰਿਪਲੇਸ ਕਰਵਾ ਦਿਉ ਥੈਂਕ ਯੂ